ਮੇਰੀ ਜ਼ਿੰਦਗੀ ਦਾ ਇੱਕੋ ਟੀਚਾ ਸੀ ਮੈਂ ਟੀਚਰ ਲੈਨ ਜਾਣਾ ਚਾਹੁੰਦੀ ਸੀ ਪਰ ਮੇਰਾ ਸੁਫਨਾ ਵਿੱਚ ਹੀ ਰਹਿ ਗਿਆ ਉਸ ਟਾਈਮ ਬੱਚਿਆਂ ਨੂੰ ਲੜਕੀਆਂ ਨੂੰ ਬਾਹਰ ਨਹੀਂ ਭੇਜਦੇ ਸੀਗੇ ਸਾਡੇ ਮੰਮੀ ਪਾਪਾ ਰਾਂ ਨੂੰ ਇਹ ਹੀ ਸੀ ਕਿ ਅਸੀਂ ਚੰਡੀਗੜ੍ਹ ਬੱਚਿਆਂ ਨੂੰ ਨਹੀਂ ਭੇਜ ਸਕਦੇ ਦੂਰ ਨਹੀਂ ਭੇਜ ਸਕਦੇ ਘਰੋਂ ਕੱਢਣਾ ਵੀ ਨਹੀਂ ਚਾਹੁੰਦੇ ਸੀਗੇ ਪਰ ਮੇਰੇ ਫੋਮ ਲਿਆਉਂਦੇ ਹੀ ਘਰ ਰਹਿ ਗਏ ਮੈਨੂੰ ਨਹੀਂ ਉਨ੍ਹਾਂ ਨਾ ਕੋਰਸ ਕਰਨ ਦਿੱਤਾ ਪਰ ਮੈਂ ਜਿੱਥੇ ਸੀ ਉੱਥੇ ਹੀ ਦਸਵੀਂ ਕਲਾਸ ਤੋਂ ਬਾਅਦ ਰਹਿ ਗਈ ਪਰ ਮੇਰਾ ਸੁਫਨਾ ਵਿੱਚ ਹੀ ਰਹਿ ਗਿਆ